ਸੌ ਇੱਕ ਹਜ਼ਾਰ ਇੱਕ ਸੌ ਇੱਕ ਪੰਜ ਲੱਖ ਚੁਰਾਸੀ ਹਜ਼ਾਰ ਨੌਂ ਲੱਖ ਅੱਸੀ ਹਜ਼ਾਰ ਨੌਂ ਸੌ ਨੱਬੇ ਨੌਂ ਸੌ ਨੜਿਨਵੇਂ ਦੋ ਲੱਖ ਪਝੱਤਰ ਹਜ਼ਾਰ